ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਲਾਈ ਕਢਾਈ ਅਤੇ ਸਲਾਈ ਕਢਾਈ ਕਰਦੀ ਹਾਂ ਕਿਉਂਕਿ ਸਿਲਾ ਕ ਸਲਾਈ ਕਢਾਈ ਦਾ ਮੈਂ ਕੋਰਸ ਕੀਤਾ ਹੋਇਆ ਏ ਛੇ ਮਹੀਨੇ ਦਾ ਇਸ ਕਰਕੇ ਮੈਨੂੰ ਸਲਾਈ ਕਢਾਈ ਬਹੁਤ ਪਸੰਦ ਹੈ ਮੈਂ ਡਿਜਾਈਨਰ ਸੂਟ ਵੀ ਬਣਾ ਲੈਂਦੀ ਹਾਂ ਪਠਾਣੀ ਸੂਟ ਪਟਿਆਲਾ ਸੂਟ ਡਰੈੱਸਾਂ ਵੀ ਸਕੂਲ ਦੀਆਂ ਸੀ ਲੈਂਦੀ ਹਾਂ ਅਤੇ ਪਜਾਮੇ ਕੁੜਤੇ ਵੀ ਸੀ ਲੈਂਦੀ ਹਾਂ ਅਤੇ ਬਹੁਤ ਹੀ ਵਧੀਆ ਢੰਗ ਨਾਲ ਲੜਕੀਆਂ ਨੂੰ ਵੀ ਸਿਖਾਉਂਦੀ ਹਾਂ ਪੰਜ ਛੇ ਲੜਕੀਆਂ ਮੇਰੇ ਕੋਲ ਸਿੱਖਣ ਆਉਂਦੀਆਂ ਹਨ ਸਲਾਈ ਅਤੇ ਕਢਾਈ ਵੀ ਕਢਾਈ ਦਾ ਕੰਮ ਵੀ ਕਰ ਲੈਂਦੀ ਹਾਂ ਚੁੰਨੀਆਂ ਅਤੇ ਫੁਲਕਾਰੀ ਵੀ ਕਢਾਈ ਵੀ ਕੱਢਦੀ ਹਾਂ ਸੂਈ ਧਾਗੇ ਨਾਲ ਅਤੇ ਮਸ਼ੀਨੀ ਕੰਮ ਵੀ ਕਰ ਲੈਂਦੀ ਹਾਂ ਅਤੇ ਪੀਕੋ ਅਤੇ ਇੰਟਰਲੋਕ ਵੀ ਕਰ ਲੈਂਦੀ ਹਾਂ